ਹੈਲੋ ਹਾਂਜੀ ਕੌਣ ਬੋਲਦੇ ਤੁਸੀਂ ਹਾਂਜੀ ਹਾਂਜੀ ਮੈਂ ਪ੍ਰਿਅੰਕਾ ਬੋਲ ਰਹੀ ਸੀ ਅਤੇ ਅਸੀਂ ਆਪਣਾ ਅਸੀਂ ਆਪਣਾ ਕਿਚਨ ਤਿਆਰ ਕਰਵਾਉਣਾ ਸੀ ਅਤੇ ਕਿਚਨ ਦੇ ਸਾਰੇ ਤਿਆਰ ਕਰਵਾਉਣ 'ਚ ਕਿੰਨਾ ਕੁ ਖਰਚਾ ਆ ਜਾਏਗਾ ਨਹੀਂ ਇਹ ਤਾਂ ਬਹੁਤ ਜ਼ਿਆਦਾ ਹੋਜੇਗਾ ਫਿਰ ਵੀ ਨਹੀਂ ਫਿਰ ਵੀ ਤੁਸੀਂ ਕੁਝ ਹੋਰ ਘੱਟ ਕਰ ਸਕਦੇ ਹੋ ਤਾਂ ਹਾਂਜੀ ਹਾਂਜੀ ਅਤੇ ਤੁਹਾਡੇ ਮਤਲਬ ਬਣਾਏ ਹੋਏ ਸਮਾਨ ਦੀ ਕਿੰਨੇ ਟਾਈਮ ਲਈ ਗਰੰਟੀ ਹੋਏਗੀ ਹਾਂਜੀ ਅਸੀਂ ਹਾਂਜੀ ਅਸੀਂ ਪਹਿਲੇ ਕਰਵਾਇਆ ਸੀ ਕੰਮ ਤਾਂ ਉਹ ਮਤਲਬ ਸਹੀ ਨਹੀਂ ਨਿਕਲਿਆ ਅਤੇ ਹੁਣ ਸਾਨੂੰ ਪੂਰੀ ਗਰੰਟੀ ਅਤੇ ਵਧੀਆ ਤਰ੍ਹਾਂ ਦਾ ਕੰਮ ਚਾਹੀਦਾ ਹਾਂਜੀ ਅਤੇ ਤੁਸੀਂ ਪਹਿਲੇ ਕੋਈ ਕਿਚਨ ਤਿਆਰ ਕਰਵਾਇਆ ਹੋਵੇ ਤੁਹਾਡੇ ਕੋਲ ਉਹਦੇ ਨਾਲ ਸੰਬੰਧਿਤ ਕੋਈ ਫੋਟੋਆਂ ਵਗੈਰਾ ਹੋਣਗੀਆਂ ਹਾਂਜੀ ਅਸੀਂ ਆਪਣਾ ਕੰਮ ਸ਼ੁਰੂ ਮਤਲਬ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦੇ ਤੁਸੀਂ ਕਦੋਂ ਤੱਕ ਸਟਾਰਟ ਕਰੋਗੇ

ਹਾਂਜੀ ਤੁਸੀਂ ਇੱਕ ਵਾਰ ਕਿਚਨ ਦੇਖ ਕੇ ਦੱਸ ਸ ਆ ਕੇ ਮਤਲਬ ਵੇਖ ਕੇ ਦੱਸ ਸਕਦੇ ਹੋ ਕਿੰਨਾ ਕੁ ਟਾਈਮ ਕਿੰਨੇ ਦਿਨਾਂ 'ਚ ਤਿਆਰ ਹੋ ਜਾਏਗਾ ਕਿਚਨ ਹਾਂਜੀ ਸਾਨੂੰ ਜਲਦੀ ਤੋਂ ਜਲਦੀ ਚਾਹੀਦਾ ਤਿਆਰ ਠੀਕ ਆ ਹਾਂਜੀ ਹਾਂਜੀ ਓਕੇ ਥੈਂਕ ਯੂ